ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਜਲੰਧਰ ਤੋਂ ਬੋਲ ਰਹੇ ਹਾਂ ਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਹਾਂ ਕਿਸ ਬਾਰੇ ਤੁਹਾਨੂੰ ਜਾਣਕਾਰੀ ਚਾਹੀਦੀ ਹ ਮਤਲਬ ਤੁਸੀਂ ਆਪਣੇ ਬੱਚੇ ਨੂੰ ਭੇਜਣਾ ਚਾਹੁੰਦੇ ਹੋ ਜਨਰਲ ਵੈਸੇ ਹੀ ਜਾਣਕਾਰੀ ਲੈਣਾ ਚਾਹੁੰਦੇ ਹੋ ਆਪਣੀ ਆਪਣੀ ਅੱਛਾ ਮੈਮ ਐਦਾਂ ਨਾ ਸਾਡਾ ਜਿਹੜਾ ਕਲੱਬ ਹੈਗਾ ਉਹ ਸਮਾਰਟ ਕਿਡਸ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹ ਔਰ ਪੰਜਾਬ ਵਿੱਚ ਬਹੁਤ ਹੀ ਮਸ਼ਹੂਰ ਕਲੱਬ ਹ ਇੱਥੇ ਸਾਡਾ ਜਿਹੜਾ ਮੇਨ ਦੋਰ ਹੁੰਦਾ ਉਹ ਆਪਾਂ ਬੱਚਿਆਂ ਨੂੰ ਬੱਚਿਆਂ ਦੀ ਗਰੋਥ ਵੱਲ ਜਿਆਦਾ ਧਿਆਨ ਦਿੰਦੇ ਆਂ ਜਿਹੜੇ ਬੱਚੇ ਅੱਜ ਕੱਲ ਛੋਟੇ ਛੋਟੇ ਬੱਚਿਆਂ ਨਾ ਉਹ ਬੱਚਿਆਂ ਨੂੰ ਪੜ੍ਹਾਇਆ ਤਾਂ ਜਾਂਦਾ ਸਕੂਲਾਂ ਵਿੱਚ ਪਰ ਉਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਮਾਨਸਿਕ ਸਥਿਤੀ ਨੂੰ ਉਹਨਾਂ ਨੂੰ ਹਰ ਜਿਆਦਾ ਆਪਾਂ ਸਟਰੋਂਗ ਕਰਨ ਲਈ ਆਪਾਂ ਉਹਨਾਂ ਨੂੰ ਵੱਖਰੀਆਂ ਵੱਖਰੀਆਂ ਐਕਟੀਵਿਟੀਜ਼ ਕਰਾਉਂਦੇ ਹੁੰਨੇ ਆ ਤਾਂ ਕੀ ਬੱਚਾ ਜਿਹੜਾ ਹੈਗਾ ਮੈਂਟਲੀ ਪ੍ਰੈਜੈਂਟ ਰਵੇ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਠੀਕ ਹ ਜਿੱਦਾਂ ਸਕੂਲਾਂ ਵਿੱਚ ਤਾਂ ਚਲੋ ਬੱਚਿਆਂ ਨੇ ਸਿਲੇਬਸ ਪੜਨਾ ਹੈ ਉਹਦੇ ਨੰਬਰ ਲੈ ਕੇ ਪਾਸ ਹੋਣਾ ਪਰ ਜੋ ਆਪਾਂ ਇਥੇ ਐਕਟੀਵਿਟੀ ਸਮਰ ਕੈਂਪ 'ਚ ਕਰਵਾਉਦੇ ਆ ਜਾਂ ਆਪਾਂ ਉਹਨਾਂ ਨੂੰ ਕੈਂਪਸ ਲਗਵਾਉਦੇ ਆ ਉਹ ਕਰਵਾਉਂਦੇ ਆ ਉਹਦੇ ਵਿੱਚ ਆਪਾਂ ਬੱਚਿਆਂ ਨੂੰ ਰੀਅਲ ਲਾਈਫ ਸਿਚੁਏਸ਼ਨ ਦੇ ਨਾਲ ਨਾਲ ਲਿੰਕ ਕਰਕੇ ਫਿਰ ਆਪਾਂ ਸਮਝਾਣਾ ਉਹਨਾਂ ਨੂੰ ਕਿ ਤੁਸੀਂ ਕਿਸ ਤਰ੍ਹਾਂ ਹਰ ਸਿਚੁਏਸ਼ਨ ਨੂੰ ਫੇਸ ਕਰਨਾ ਠੀਕ ਹ ਕਿਉਂਕਿ ਜਦੋਂ ਹੁਣ ਅੱਜਕੱਲ ਦੌਰ ਹੀ ਮੈਂ ਇਦਾਂ ਦਾ ਆ ਗਿਆ ਜ ਜਦੋਂ ਤੱਕ ਆਪਾਂ ਛੋਟੇ ਬੱਚੇ ਨੂੰ ਸਮਝਾਵਾਂਗੇ ਨਹੀਂ ਅੱਗੇ ਜਾ ਕੇ ਆਪਣੀ ਲਾਈਫ ਵਿੱਚ ਉਹ ਸਹੀ ਨਹੀਂ ਕਰ ਪਾਏਗਾ ਨਾ ਠੀਕ ਆ ਔਰ ਅੱਜ ਕੱਲ ਸਕੂਲ ਕੋਲਜ ਵੀ ਅੱਜ ਕੱਲ ਐਨੀ ਨੋਲਜ ਦਿੰਦੇ ਨੀ ਪ੍ਰੈਕਟੀਕਲੀ ਇਸ ਕਰਕੇ ਥੋੜਾ ਜਿਹਾ ਆਪਾਂ ਨਾ ਅਡੀਸ਼ਨਲ ਕਰਾ ਦੀਦਾ ਬੱਚਿਆਂ ਨੂੰ ਹਾਂ ਨਹੀਂ ਮੈਮ ਐਦਾਂ ਨਾ ਹਾਂਜੀ ਹਾਂਜੀ ਬਿਲਕੁਲ ਅਸੀਂ ਬੱਚਿਆਂ ਦੇ ਨਾ ਉਮਰ ਦੇ ਹਿਸਾਬ ਨਾਲ ਉਹਨਾਂ ਦੇ ਬੈਚ ਬਣਾਏ ਹੋਏ ਨੇ ਜਿੱਦਾਂ ਜਿਹੜੇ ਬੱਚੇ ਦਸ ਸਾਲ ਤੱਕ ਦੇ ਬੱਚੇ ਹੁੰਦੇ ਨੇ ਉਹਨਾਂ ਦੇ ਆਪਾਂ ਬੈਚ ਵੱਖਰਾ ਬਣਾਈਦਾ ਉਸ ਤੋਂ ਉਪਰ ਸੱਤ ਤੋਂ ਲੈ ਕੇ ਪੰਦਰਾਂ ਤੱਕ ਪੰਦਰਾਂ ਸਾਲ ਤੱਕ ਤੋਂ ਜਿਹੜੇ ਬੱਚੇ ਹੋਣਗੇ ਉਹਨਾਂ ਦੇ ਬੈਚ ਅਲਗ ਹੁੰਦਾ ਤੇ ਕਿਉਂਕਿ ਆਪਾਂ ਇਹ ਵੀ ਇਸ ਲਈ ਕਰਦੇ ਆ ਕਿਉਂਕਿ ਜਿਹੜੇ ਬੱਚੇ ਹਰ ਏਜ ਵਿੱਚ ਹੁੰਦੇ ਨਾ ਹਰ ਉਮਰ ਦੇ ਬੱਚੇ ਉਹਨਾਂ ਦੇ ਥੋੜੀ ਸੋਚਣੀ ਥੋੜੀ ਵੱਖਰੀ ਹੁੰਦੀ ਆ ਹਨਾ ਤੇ ਉਹ ਬੱਚੇ ਐਹ ਇਵੈਂਟ ਆਪਾਂ ਨਾ ਵੈਸੇ ਤਾਂ ਕੈਂਪ ਮਹੀਨਾ ਚਲਦਾ ਪਰ ਕਈ ਵਾਰ ਜਿਹੜੇ ਪੇਰੈਂਟਸ ਹੁੰਦੇ ਨਾ ਉਹ ਇੰਨੇ ਟਾਈਮ ਲਈ ਬੱਚੇ ਨੂੰ ਭੇਜਦੇ ਨਹੀਂ ਹੈਗੇ ਇਸ ਲਈ ਆਪਾਂ ਉਹਨੂੰ ਪੇਰੈਂਟ ਲਈ ਹਫਤਾ ਤੇ ਪੰਦਰਾਂ ਦਿਨ ਦੀ ਆਪਸ਼ਨ ਵੀ ਰੱਖਦੇ ਹੈਗੇ ਆ ਕਿ ਅਗਰ ਉਹ ਚਾਹਣ ਤੇ ਉਹ ਪੰਦਰਾਂ ਦਿਨ ਜਾਂ ਹਫਤੇ ਲਈ ਆਪਣੇ ਬੱਚੇ ਨੂੰ ਸਾਡੇ ਕੋਲ ਭੇਜ ਕੇ ਉਹਦੀ ਜਿਹੜੀ ਗਰੋਥ ਨੇ ਉਹ ਦੇਖ ਸਕਦੇ ਨੇ ਔਰ ਬੱਚੇ ਬਹੁਤ ਅੱਛਾ ਪਰਫੋਮ ਕਰ ਜਾਂਦੇ ਨੇ ਜਦੋਂ ਆਪਣੇ ਘਰ ਦੇ ਮਾਹੌਲ ਤੋਂ ਬਾਹਰ ਜਾਂਦੇ ਨੇ ਠੀਕ ਆ ਸਕੂਲ ਦੇ ਮਾਹੌਲ ਤੋਂ ਬਾਹਰ ਜਾ ਕੇ ਨਵੇਂ ਨਵੇਂ ਬੱਚਿਆਂ ਨੂੰ ਮਿਲਦੇ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਜਰੂਰ ਮੈਂ ਤੁਹਾਨੂੰ ਬਿਲਕੁਲ ਪੂਰੀ ਪੂਰੀ ਡਿਟੇਲ ਸਾਰਾ ਸਾਰਾ ਵੇਰਵਾ ਤੁਹਾਨੂੰ ਬਿਊਰੋ ਮੈਂ ਭੇਜ ਦਿੰਨੀ ਆ ਕਿ ਕਿੰਨੇ ਬੱਚੇ ਇਨਰੋਲ ਹੁੰਦੇ ਨੇ ਤੇ ਕੀ ਕੀ ਹੋਰ ਉਪਲੱਬਧੀਆਂ ਬੱਚਿਆਂ ਨੂੰ ਮਿਲ ਸਕਦੀਆਂ ਨੇ ਸਤਿ ਸ੍ਰੀ ਅਕਾਲ ਮੈਮ